ਰੋਪੜ ਖੇਤਰ ਦੇ ਵਿੱਚ ਕੁਪੋਸ਼ਣ ਦੀ ਇੱਕ ਸਮੱਸਿਆ ਕੋਈ ਖਾਸ ਸਮੱਸਿਆ ਨਹੀਂ ਹੈਗੀ ਅਤੇ ਇਹ ਬਿਲ ਬਹੁਤ ਹੀ ਘੱਟ ਸਮੱਸਿਆ ਹੈ ਅਤੇ ਇੱਥੇ ਦੇ ਸਾਰੇ ਲੋਕਾਂ ਨੂੰ ਤਕਰੀਬਨ ਨੱਬੇ ਫ਼ੀਸਦੀ ਲੋਕਾਂ ਨੂੰ ਚੰਗਾ ਪਾਣੀ ਅਤੇ ਚੰਗੀ ਗੁਣਵੱਤਾ ਵਾਲਾ ਭੋਜਨ ਮਿਲਦਾ ਹੈ ਸਰਕਾਰ ਮੁਆਵਜ਼ਾ ਕਰਵਾਉਂਦੀ ਹੈ ਅਤੇ ਇੱਥੇ ਕਈ ਗੁਰਦੁਆਰੇ ਵੀ ਹਨ ਜਿਹੜੇ ਕਿ ਦਿਨ ਰਾਤ ਲੰਗਰ ਚੱਲਦੇ ਰਹਿੰਦੇ ਹਨ ਅਤੇ ਉਸ ਤੋਂ ਬਾਅਦ ਜਿਹੜੇ ਦਸ ਪਰਸੈਂਟ ਜਿਹੜੇ ਵਿਅਕਤੀ ਨੇ ਵੀ ਜੇਹੜ ਜਿਨ੍ਹਾਂ ਨੂੰ ਚੰਗਾ ਪਾਣੀ ਸਾਫ਼ ਪਾਣੀ ਅਤੇ ਭੋਜਨ ਨਹੀਂ ਮਿਲਦਾ ਅਤੇ ਉਹ ਉਹ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਾਨੂੰ ਐਨ ਜੀ ਓ ਜਿਹੜੀ ਸੰਸਥਾਵਾਂ ਨੇ ਉਹਨਾਂ ਦਾ ਸਾਥ ਲੈਣਾ ਚਾਹੀਦਾ ਹੈ ਅਤੇ ਸਾਨੂੰ ਸਰਕਾਰੀ ਸਕੀਮਾਂ ਬਣਾਉਣੀਆਂ ਚਾਹੀਦੀਆਂ ਹਨ ਜਿਹਦੇ ਨਾਲ ਉਹਨਾਂ ਭੁੱਖਿਆਂ ਨੂੰ ਵੀ ਅਸੀਂ ਪਿਆਸਿਆਂ ਨੂੰ ਵੀ ਅਸੀਂ ਚੰਗਾ ਭੋਜਨ ਅਤੇ ਪਾਣੀ ਪ੍ਰਾਪਤ ਕਰਾ ਸਕੀਏ